ਇੱਕ ਵਾਰ ਸਾਡੇ ਉਡਦਾ ਉਡਦਾ ਮੋਰ ਆ ਕੇ ਡਿੱਗ ਗਿਆ ਸੀ ਉਹ ਜ਼ਖ਼ਮੀ ਸੀ ਅਸੀਂ ਮਤਲਬ ਉਹ ਉਹਨੂੰ ਪਾਣੀ ਪਿਲਾਇਆ ਉਹਦੀ ਰੂੰ ਦੇ ਨਾਲ ਉਹਦਾ ਜਿੱਥੇ ਖੂ ਬਲੱਡ ਵਗੈਰਾ ਲੱਗਿਆ ਸੀ ਉਹਨੂੰ ਸਾਫ਼ ਕੀਤਾ ਮਤਲਬ ਸਾਨੂੰ ਖੁਸ਼ੀ ਹੋਈ ਕਿ ਅਸੀਂ ਉਹਨੂੰ ਮਤਲਬ ਠੀਕ ਕਰਦੇ ਸੀ ਕਿ ਹਾਂ ਉਹ ਦੋ ਚਾਰ ਦਿਨਾਂ ਦੇ ਵਿੱਚ ਮਤਲਬ ਉਹ ਮੋਰ ਸੀ ਜਿਹੜਾ ਉੱਡਣ ਲੱਗ ਸੀ ਇਹ ਸਾਡੇ ਪਿੰਡ ਦੀ ਗੱਲ ਹੈ ਅਤੇ ਮਤਲਬ ਇਹ ਗੱਲ ਮੈਨੂੰ ਯਾਦ ਆ ਕਿ ਅਸੀਂ ਪੰਛੀਆਂ ਨੂੰ ਬੜਾ ਪਿਆਰ ਕਰਦੇ ਹੁੰਦੇ ਸੀ ਕਿ ਸਾਡੇ ਕੋਈ ਵੀ ਕਬੂਤਰ ਡਿੱਗਣਾ ਕਾਂ ਕਾਂ ਕਾਂ ਕੋਈ ਵੀ ਹੁਣ ਹੈ ਨਾ ਅਤੇ ਅਸੀਂ ਉਨ੍ਹਾਂ ਦਾ ਕਾਫ਼ੀ ਵਾਰ ਬਚਾ ਕੀਤਾ ਵਾ ਅਤੇ ਵਧੀਆ ਲੱਗਦਾ ਹੁੰਦਾ ਸੀ ਜਦੋਂ ਦਾਦੀ ਸਾਡੀ ਕਹਿੰਦੀ ਹੁੰਦੀ ਸੀ ਕਿ ਹਾਂ ਇਨ੍ਹਾਂ ਨੂੰ ਪਾਣੀ ਪਿਲਾਓ ਅਤੇ ਵੀ ਇਹ ਬਿਮਾਰ ਆ ਇਹ ਡਿੱ ਹੈ ਨਾ ਅਤੇ ਅਸੀਂ ਖੁਦ ਰੂੰ ਦੇ ਨਾਲ ਉਹਦਾ ਖੂਨ ਸਾਫ਼ ਕਰਨਾ ਅਤੇ ਅੱਛਾ ਲੱਗਦਾ ਹੁੰਦਾ ਸੀ